ਪੰਜਾਬੀ ਭਾਸ਼ਾ ਅਤੇ ਬੋਡੋ ਅਤੇ ਬੰਗਾਲੀ ਭਾਸ਼ਾਵਾਂ ਦੀ ਸਮੱਗਰੀ ਅਤੇ ਵਿਚਾਰਧਾਰਾ ਵਿੱਚ ਕਾਫੀ ਵੱਖਰੀਆਂ ਹਨ ਪੰਜਾਬੀ ਭਾਸ਼ਾ ਨੂੰ ਉੱਚੇ ਮਾਨਤੇ ਹਨ ਜੋ ਪੰਜਾਬੀ ਲੋਕ ਅਤੇ ਪੰਜਾਬੀ ਸੱਭਿਆਚਾਰ ਨੂੰ ਵਿਵਾ ਵਿਹਾਰਕ ਅਤੇ ਸਾਹਿਤਕ ਰੂਪ ਵਿੱਚ ਵਿਭਿੰਨ ਬੇਨਤੀਆਂ ਦਰਸਾਉਂਦੇ ਹਨ ਬੋਡੋ ਭਾਸ਼ਾ ਭਾਰਤੀ ਅਰੁਣਾਚਲ ਪ੍ਰਦੇਸ਼ ਦੇ ਬੋਡੋ ਜਨਤਾ ਸਮੂਹ ਦੀ ਮੁੱਖ ਭਾਸ਼ਾ ਹੈ ਜਿਸ ਵਿੱਚ ਸੰਪੂਰਨ ਵਿਸ਼ੇਸ਼ਤਾ ਦਰਸਾਈ ਜਾਂਦੀ ਹੈ ਅਤੇ ਇਸ ਨੂੰ ਭਾਰਤੀ ਭਾਸ਼ਾ ਦੇ ਰੂਪ ਵਿੱਚ ਵਰਨਾ ਅਤੇ ਕਿਸਮ ਦੇ ਰੂਪ ਵਿੱਚ ਵੀ ਦਰਸਾਇਆ ਜਾਂਦਾ ਹੈ ਬੰਗਾਲੀ ਭਾਸ਼ਾ ਵਿੱਚ ਵਿਚਾਰਧਾਰਾ ਅਤੇ ਲੇਖਕੀ ਪਰੰਪਰਾ ਦਾ ਉੱਚਾ ਮਾਨ ਹੈ ਜੋ ਉਸਦੇ ਕਵੀ ਲੇਖਕ ਅਤੇ ਸੰਗੀਤਕਾਰਾਂ ਨੂੰ ਸ਼੍ਰੇਸ਼ਟ ਕੰਮਾਂ ਵਿੱਚ ਵੱਖਰੇ ਕਰਦੇ ਹਨ ਇਹ ਤਿੰਨੇ ਭਾਸ਼ਾਵਾਂ ਸਾਂਝੇ ਇਤਿਹਾਸਿਕ ਸੰਸਕ੍ਰਿਤਿਕ ਅਤੇ ਸਾਹਿਤਕ ਕੇਂਦਰ ਦੇ ਹੋ ਸਕਦੀਆਂ ਹਨ ਪਰ ਉਹ ਵਿਭਿੰਨਤਾ ਵਿੱਚ ਵੀ ਮੁੱਖ ਹਨ ਜੋ ਉਹਨਾਂ ਨੂੰ ਹਰੇਕ ਨੂੰ ਵੱਖਰਾ ਕਰਦੀਆਂ ਹਨ